ਹਾਂਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਰ ਹਾਂਜੀ ਸਰ ਕਲੀਨਿਕ 'ਤੇ ਜੀ ਤੁਸੀਂ ਸਰ ਬਿਮਾਰ ਹੋ ਗਿਆ ਜੀ ਅਤੇ ਬੁਖ਼ਾਰ ਚੜ੍ਹਦਾ ਅਤੇ ਠੀਕ ਨਹੀਂ ਹੋ ਰਿਹਾ ਜੀ ਹਾਂਜੀ ਹਾਂਜੀ ਹਾਂਜੀ ਪੈਰਾਸੀਟਾਮੌਲ ਲੈ ਹਾਂ ਓਹਦੇ ਨਾਲ ਫਰਕ ਨਹੀਂ ਪਿਆ ਜੀ ਹਾਂਜੀ ਹਾਂਜੀ ਹਾਂ ਅਤੇ ਕੋਈ ਵਧੀਆ ਜੀ ਦਵਾਈ ਦੇ ਦਿਉ ਜੀ ਤੁਸੀਂ ਅੱਛਾ ਜੀ ਅਤੇ ਬੱਚਾ ਢਿੱਲਾ ਵੀ ਹੋ ਗਿਆ ਬਹੁਤ ਸੈੱਲ ਵੀ ਘਟੇ ਪਏ ਉਹਦੇ ਹਾਂਜੀ ਹਾਂਜੀ ਹਾਂਜੀ ਹਾਂਜੀ ਅਤੇ ਬੁਖਾਰ ਬਖੁਰ ਮਾੜਾ ਮੋਟਾ ਬੁਖਾਰ 'ਤੇ ਸੈਟ ਹੋ ਜੁਗਾ ਜੀ ਡਾਕਟਰ ਸਾਹਿਬ ਹਾਂਜੀ ਹਾਂਜੀ ਹਾਂਜੀ ਅਤੇ ਮਾੜਾ ਮੋਟਾ ਬੱਚਾ ਉਹ ਖਾਂਦਾ ਪੀਂਦਾ ਰੋਟੀ ਰਾਟੀ ਵੀ ਨਹੀਂ ਖਾਂਦਾ ਅਤੇ ਉਹ

ਹਾਂਜੀ ਹਾਂਜੀ ਹਾਂਜੀ ਡਾਕਟਰ ਸਾਹਿਬ ਅਤੇ ਰੋਟੀ ਪਾਣੀ ਖਲਾਅ ਸਕਦੇ ਜੀ ਬੱਚੇ ਨੂੰ ਆਪਾਂ ਅੱਛਾ ਹਾਂਜੀ ਹਾਂਜੀ ਅੱਛਾ ਚਾਹ ਚੁ ਚਾਹ ਅੱਛਾ ਜੀ ਹਾਂਜੀ ਅਤੇ ਸੈੱਲ ਸੈੱਲ ਬਹੁਤ ਘੱਟ ਗਏ ਆ ਸੈੱਲ ਤਾਂ ਡੇਢ ਕੁ ਡੇਢ ਕੁ ਲੱਖ ਰਹਿ ਗਏ ਸੈੱਲ ਉਹਦੇ ਬੱਚਾ ਥੋੜ੍ਹਾ ਜਿਹਾ ਉਹ ਆ ਨਾ ਵੀਕਨੈਂਸ ਪਈ ਹੋਈ ਆ ਬੱਚੇ 'ਚ ਹਾਂ ਫਿਰ ਦਵਾਈ ਆਪਾਂ ਕਿਹੜੀ ਦਈਏ ਉਹਨੂੰ ਹਾਂਜੀ ਹਾਂਜੀ ਹਾਂਜੀ ਹਾਂਜੀ ਬੁਖਾਰ ਤਾਂ ਉਹਨੂੰ ਡਾਕਟਰ ਸਾਹਿਬ ਸੌ ਕੁ ਬੁਖਾਰ ਆ ਬਸ ਅਤੇ ਬੜਾ ਕਾਂਬਾ ਵੀ ਚੜ੍ਹਦਾ ਉਹਨੂੰ ਹਾਂਜੀ ਹਾਂਜੀ ਅਤੇ ਕਾਂਬਾ ਵੀ ਚੜ੍ਹੀ ਜਾਂਦਾ ਤਾ ਉਹਨੂੰ ਕੱਪੜਾ ਕੁਪੜਾ ਉਹ ਕਰ ਹੈਂਜੀ ਹਾਂ ਹਾਂਜੀ

ਹਾਂਜੀ ਹਾਂਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਕਲੀਨਿਕ ਲੈ ਜਾਂਗੇ ਜੀ ਠੀਕ ਹੈ ਜੀ ਹਾਂਜੀ